ਹੇਅ ਗੂਗਲ ਕੀ ਤੁਸੀਂ ਮੈਨੂੰ ਆਪਣੇ ਪਟਿਆਲਾ ਸ਼ਹਿਰ ਵਿੱਚ ਖੁੱਲ੍ਹੇ ਨਵੇਂ ਲਾ ਪਿਨੋਜ਼ ਪੀਜ਼ਾ ਬਾਰੇ ਜਾਣਕਾਰੀ ਦੇ ਸਕਦੇ ਹੋ ਇਸ ਬਾਰੇ ਮੈਨੂੰ ਇਹ ਦੱਸਿਆ ਜਾਵੇ ਕਿ ਇੱਥੇ ਕਿਸ ਕਿਸ ਪ੍ਰਕਾਰ ਦੇ ਪੀਜ਼ਾ ਮਿਲਦੇ ਹਨ ਅਤੇ ਉਹਨਾਂ ਦੇ ਪੀਜ਼ਾ ਦੇ ਰੇਟਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦੇ ਰੇਟ ਕਿੰਨੇ ਕਿੰਨੇ ਹਨ ਮੈਨੂੰ ਇਹ ਵੀ ਦੱਸਿਆ ਜਾਵੇ ਕਿ ਇਹਨਾਂ ਦਾ ਸਭ ਤੋਂ ਵੱਧ ਵਿਕਣ ਵਾਲਾ ਪੀਜ਼ਾ ਕਿਹੜਾ ਹੈ ਨਾਲ ਦੀ ਨਾਲ ਮੈਨੂੰ ਇਹ ਵੀ ਦੱਸਿਆ ਜਾਵੇ ਕਿ ਇਹਨਾਂ ਦੇ ਪੀਜ਼ਾ ਦੀ ਰੇਟਿੰਗ ਕਿੰਨੀ ਹੈ ਅਤੇ ਇੱਥੇ ਕਿਸ ਕਿਸ ਪ੍ਰਕਾਰ ਦੇ ਗਾਰਲਿਕ ਬ੍ਰੈਡ ਅਤੇ ਸਟਫ ਮਿਲਦੇ ਹਨ